ਹਾਂਜੀ ਮੈਂ ਸਕੂਲ ਜਾਂ ਕਾਲਜਾਂ ਦੇ ਵਿੱਚ ਬਹੁਤ ਵਿਗਿਆਨੀਆਂ ਬਾਰੇ ਪੜ੍ਹਿਆ ਹੈ ਅਤੇ ਕੁਝ ਬਹੁਤ ਸਿੱਖਿਆ ਵੀ ਹੈ ਇੱਕ ਵਿਗਿਆਨੀਆਂ ਬਾਰੇ ਆਪਣਾ ਆਰੀਆ ਭੱਟ ਹੋਏ ਨੇ ਜਿਨ੍ਹਾਂ ਨੇ ਮਤਲਬ ਵਿਗਿਆਨੀਆਂ ਦੀ ਖੋਜ ਕੀਤੀ ਹੈ ਅਤੇ ਬਹੁਤ ਨੌਲੇਜ ਮਿਲੀ ਹੈ ਅਤੇ ਬਹੁਤ ਗਿਆਨ ਮਿਲਿਆ ਹੈ